ਮੈਂ ਕੰਸਲ ਮੁਬੈਲ ਵਾਲਿਆਂ ਤੋਂ ਮੁਬੈਲ ਖਰੀਦਿਆ ਉਨ੍ਹਾਂ ਦਾ ਮੇਰੇ ਮੁਬੈਲ ਜੋ ਮੈਂ ਸੋਚਿਆ ਸੀ ਉਹ ਮੁਬੈਲ ਬਿਲਕੁਲ ਬੇਕਾਰ ਨਿਕਲਿਆ ਨਾ ਤਾਂ ਉਹਦੀ ਕੈਮਰੇ ਦੀ ਕਲੀਅਰਟੀ ਨਾ ਹੀ ਉਹਦੇ 'ਚ ਅਵਾਜ਼ ਸਾਫ਼ ਆਉਂਦੀ ਸੀਗੀ ਸਭ ਤੋਂ ਬੁਰਾ ਐਕਸਪੀਰੀਐਂਸ ਸੀ ਮੇਰਾ ਮੈਂ ਕਹਿ ਰਿਹਾ ਵੀ ਉਨ੍ਹਾਂ ਤੋਂ ਕੋਈ ਵੀ ਕੋਈ ਮੁਬੈਲ ਨਾ ਖਰੀਦੇ ਫਿਰ ਉਨ੍ਹਾਂ ਦਾ ਬਾਕੀ ਕਿਸ਼ਤਾਂ ਵਗੈਰਾ ਜਿਹੜੀਆਂ ਹੈਗੀਆਂ ਉਹ ਵੀ ਉਹ ਜ਼ਿਆਦਾ ਐਂ ਕਹਿ ਰਹੇ ਸੀਗੇ ਪਹਿਲਾਂ ਕਹਿ ਰਹੇ ਸੀਗੇ ਨਹੀਂ ਕਿਸ਼ਤੇ 'ਤੇ ਵਿਆਜ ਨਹੀਂ ਲੱਗਦਾ ਫਿਰ ਬਾਅਦ ਵਿੱਚ ਉਨ੍ਹਾਂ ਨੇ ਵਿਆਜ ਵੀ ਲਗਾਇਆ ਇਸ ਕਰਕੇ ਪਲੀਜ਼ ਕੋਈ ਉਨ੍ਹਾਂ ਤੋਂ ਮੁਬੈਲ ਨਾ ਖਰੀਦੇ